ਬਲਜਿੰਦਰ ਭਾਅ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਬਲਜਿੰਦਰ ਭਾਅ ਜੀ ਤੁਹਾਡੇ ਕੋਲੋਂ ਟੈਕਸੀ ਬੁੱਕ ਕਰਾਈ ਸੀਗੀ ਜੀ ਅਤੇ ਆਪਾਂ ਪਰਸੋਂ ਮਨਾਲੀ ਜਾਣਾ ਸੀਗਾ ਬਹੁਤ ਜ਼ਿਆਦਾ ਜ਼ਰੂਰੀ ਕੰਮ ਪੈ ਗਈ ਮੇਰੇ ਫਾਦਰ ਸਾਹਿਬ ਬਿਮਾਰ ਹੋ ਗਏ ਅਤੇ ਉਹਨਾਂ ਨੂੰ ਐਮਰਜੈਂਸੀ ਮੈਨੂੰ ਲੈ ਕੇ ਜਾਣਾ ਪੈ ਗਿਆ ਜੀ ਹੁਣ ਜਿਹੜਾ ਚੰਡੀਗੜ ਦਾ ਪਲੈਨ ਸੀਗਾ ਜੀ ਹੁਣ ਉਹ ਆਪਾਂ ਦੋ ਹਫਤੇ ਬਾਅਦ ਬਣਾ ਲਵਾਂਗੇ ਜੀ ਮੈਨੂੰ ਬਹੁਤ ਜ਼ਿਆਦਾ ਜ਼ਰੂਰੀ ਜਾਣਾ ਪੈ ਗਿਆ ਅਤੇ ਕੋਈ ਚੱਕਰ ਨਹੀਂ ਤੁਹਾਡੇ ਦੁਆਰਾ ਤੁਹਾਡੇ ਦੁਆਰਾ ਹੀ ਤੁਹਾਡੀ ਟੈਕਸੀ ਦੁਆਰਾ ਹੀ ਵਾਪਿਸ ਜਾਵਾਂ ਉੱਥੇ ਚੰਡੀਗੜ੍ਹ ਜਾਵਾਂਗੇ ਜੀ ਅਤੇ ਜਿਹੜੇ ਵੀ ਹੁਣ ਤੁਹਾਨੂੰ ਪੇਮੈਂਟ ਕਰੀ ਸੀਗੀ ਜੀ ਆਨਲਾਈਨ ਮੈਂ ਉਹਦੇ ਵਿੱਚੋਂ ਜੋ ਵੀ ਤੁਹਾਡੀ ਬਣਦਾ ਪੈਸੇ ਉਹ ਕੱਟ ਕੇ ਮੈਨੂੰ ਜਿਹੜੀ ਪੇਮੈਂਟ ਆ ਜੀ ਵਾਪਿਸ ਕਰਦੋ ਜਦੋਂ ਵੀ ਦੁਬਾਰਾ ਪਲੈਨ ਬਣੂਂਗਾ ਜੀ ਦੋ ਹਫਤੇ ਬਾਅਦ ਉਹਤੋਂ ਤੁਹਾਡੇ ਨਾਲ ਹੀ ਜਾਵਾਂਗੇ ਜੀ ਚੰਡੀਗੜ੍ਹ ਨੂੰ ਸ਼ੁਕਰੀਆ ਜੀ ਧੰਨਵਾਦ